ਸਤਿ ਸ਼੍ਰੀ ਅਕਾਲ ਭਾਅ ਜੀ ਕੁਮਾਰ ਗੌਰਵ ਜੀ ਗੱਲ ਕਰ ਰਹੇ ਜੀ ਹਾਂਜੀ ਹਾਂਜੀ ਭਾਅ ਜੀ ਮੈਂ ਥੋਹਾਤੇ ਥੋੜ੍ਹੇ ਦਿਨ ਪਹਿਲਾਂ ਨਾ ਫ਼ੋਨ ਲੈ ਕੇ ਗਿਆ ਸੀਗਾ ਜੀ ਵੀਵੋ ਦਾ ਜੀ ਨਿਊ ਉਹ ਫ਼ੋਨ ਬੜਾ ਵਧੀਆ ਜੀ ਕੈਮਰਾ ਕੋਆਲਟੀ ਬੜੀ ਘੈਂਟ ਹੈ ਜੀ ਫ਼ੋਨ ਦੀ ਆਵਾਜ਼ ਨਮ ਵੌਇਸ ਕੋਆਲਟੀ ਬੜੀ ਘੈਂਟ ਹੈ ਜੀ ਉਹਦੀ ਫ਼ੋਨ ਦੀ ਤੁਹਾਡੇ ਦੀ ਹਾਂਜੀ ਬਹੁਤ ਵਧੀਆ ਫ਼ੋਨ ਹੈ ਜੀ ਬੈਟਰੀ ਪੈਕਅੱਪ ਬਹੁ ਵਧੀਆ ਭਾਅ ਜੀ ਹਾਂਜੀ ਲੰਬੇ ਸਮੇਂ ਕੱਢ ਦਿੰਦਾ ਜੀ ਟੈਮ ਔਰ ਉਸ ਤੋਂ ਬਾਅਦ ਕੈਮਰਾ ਭਾਅ ਜੀ ਬਹੁ ਵਧੀਆ ਫ਼ੋਨ ਦਾ ਫਰੰਟ ਵਾਲਾ ਵੀ ਅਤੇ ਬੈਕ ਕੈਮਰਾ ਵੀ ਬਹੁ ਵਧੀਆ ਹੈ ਔਰ ਐਂ ਭਾਅ ਜੀ ਵੀ ਕਿਤੇ ਲੰਬੇ ਟੂਰ 'ਤੇ ਜਾਣਾ ਬੰਦੇ ਨੇ ਆਪਣਾ ਇੱਕ ਵਾਰ ਚਾਰਜ ਕਰਕੇ ਮੁੜਕੇ ਕੋਈ ਦਿੱਕਤ ਨਹੀਂ ਹੈਗੀ ਚਾਰਜ ਕਰਨ ਦੀ ਹਾਂਜੀ ਭਾਅ ਜੀ ਫਾਸਟ ਚਾਰਜ ਲੱਗਦਾ ਹੈ ਜਿਹੜਾ ਕਿ ਘੰਟੇ ਵਿੱਚ ਫੁੱਲ ਚਾਰਜ ਕਰ ਦਿੰਦਾ ਫ਼ੋਨ ਉਹਦੇ ਕਰਕੇ ਸਾਨੂੰ ਬੜਾ ਫਾਇਦਾ ਹੋ ਗਿਆ ਹਾਂਜੀ ਭਾਅ ਜੀ ਬੜਾ ਧੰਨਵਾਦ ਹੈ ਤੁਹਾਡਾ ਅ ਸਾਨੂੰ ਤੁਸੀਂ ਇਸ ਫ਼ੋਨ ਲਈ ਗਾਈਡ ਕੀਤਾ ਧੰਨਵਾਦ ਬਾਈ ਜੀ